ਭੰਗੜਾ ਪੰਜਾਬ ਦਾ ਫੋਕ ਡਾਂਸ ਹੈ ਭੰਗੜਾ ਬੜੇ ਹੀ ਚਾਅ ਦੇ ਨਾਲ ਪੰਜਾਬ ਦੇ ਵਿੱਚ ਪਾਇਆ ਜਾਂਦਾ ਹੈ ਇਹ ਵਿਆਹ ਸ਼ਾਦੀਆਂ ਕਾਲਜਾਂ ਦੇ ਵਿੱਚ ਫੰਕਸ਼ਨਾਂ ਦੇ ਉੱਤੇ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਇਸ ਨੂੰ ਫੰਕਸ਼ਨਾਂ ਦੇ ਵਿੱਚ ਭਾਗ ਲੈ ਕੇ ਇਸ ਦੇ ਮੁਕਾਬਲੇ ਕਰਾਏ ਜਾਂਦੇ ਹਨ ਪਰ ਮੇਰਾ ਜੋ ਨਜ਼ਰੀਆ ਇਹ ਹੈ ਕਿ ਜਿਹੜਾ ਭੰਗੜਾ ਐਰੋਬਿਕਸ ਹੈ ਉਹ ਪੰਜਾਬ ਦੇ ਭੰਗੜੇ ਨੂੰ ਥੋੜ੍ਹਾ ਪਿੱਛੇ ਲੈ ਕੇ ਜਾ ਰਿਹਾ ਹੈ ਇਹ ਉਸਨੂੰ ਅੱਗੇ ਲਾ ਲੈ ਕੇ ਜਾਣ ਦੇ ਵਿੱਚ ਯੋਗਦਾਨ ਘੱਟ ਪਾ ਰਿਹਾ ਹੈ ਕਿਉਂਕਿ ਪੰਜਾਬ ਦਾ ਜਿਹੜਾ ਫੋਕ ਡਾਂਸ ਹੈ ਉਹ ਭੰਗੜਾ ਹੈ ਅਤੇ ਭੰਗੜੇ ਦੇ ਨਾਲ ਸਾਡਾ ਇੱਕ ਸਰੀਰਕ ਕਸਰਤ ਦੇ ਤੌਰ 'ਤੇ ਵੀ ਇਸ ਨੂੰ ਯੂਜ਼ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਭੰਗੜਾ ਜਿਹੜਾ ਹੈ ਉਹ ਇੱਕ ਬਹੁਤ ਹੀ ਪੁਰਾਣਾ ਸਾਡਾ ਨਾਚ ਹੈ ਜੋ ਬਹੁਤ ਹੀ ਸਾਲਾਂ ਤੋਂ ਇਹ ਵਰਤੋਂ ਦੇ ਵਿੱਚ ਆ ਰਿਹਾ ਹੈ ਪੰਜਾਬ ਅਤੇ ਪੰਜਾਬੀਆਂ ਦੀ ਸ਼ਾਨ ਹੀ ਭੰਗੜਾ ਹੈ ਭੰਗੜਾ ਜੋ ਹੈ ਉਹ ਬਹੁਤ ਹੀ ਚੰਗੇ ਨਾਚ ਦੇ ਵਿੱਚ ਆਉਂਦਾ ਹੈ ਅਤੇ ਇਸ ਨੂੰ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਇਸ ਨੂੰ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ ਧੰਨਵਾਦ